ਸਾਡੇ ਪਿੰਡ ਦੇ ਪਰਿਵਾਰਾਂ ਵਿੱਚ ਝਗੜਿਆਂ ਦਾ ਹੱਲ ਕੋਟ ਕਚਹਿਰੀਆਂ ਪੁਲਿਸ ਥਾਣਿਆਂ ਵਿੱਚ ਜਾ ਕੇ ਨਹੀਂ ਹੁੰਦਾ ਸਾਡੇ ਪਿੰਡ ਦੇ ਜਿਹੜੇ ਜ਼ਿਆਦਾਤਰ ਝਗੜੇ ਨੇ ਉਹਨਾਂ ਦਾ ਹੱਲ ਪਿੰਡ ਦੇ ਨ ਜਿਹੜੇ ਮੋਢੀ ਬੰਦੇ ਨੇ ਜਾਂ ਜਿਹੜੇ ਨੰਬੜਦਾਰ ਨੇ ਪੁਰਾਣੇ ਬਜ਼ੁਰਗ ਨੇ ਉਹ ਵਿੱਚ ਪੈ ਕੇ ਕਰਵਾ ਦਿੰਦੇ ਨੇ ਮੋਸਟਲੀ ਇਹ ਸਾਨੂੰ ਥਾਣੇ ਕਚਹਿਰੀਆਂ ਕੋਟ ਕਚਹਿਰੀਆਂ ਤੋਂ ਸਾਡਾ ਪਿੰਡ ਬਹੁਤ ਦੂਰ ਰਹਿੰਦਾ ਕੋਈ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਵਾਲੀ ਗੱਲ ਹੋਵੇ ਜਾਂ ਫਿਰ ਕੋਈ ਕ ਝਗੜਾ ਨਾ ਸੁਲਝਦਾ ਹੋਵੇ ਤਾਂ ਇਹ ਝਗ ਤਾਂ ਬਹੁਤ ਹੀ ਦੇਰ ਤੱਕ ਜੋ ਝਗੜੇ ਦੀ ਜੜ ਖਤਮ ਹੀ ਨਾ ਹੋ ਰਹੀ ਹੋਵੇ ਤਾਂ ਕੋਈ ਝਗੜਾ ਪੁਲਿਸ ਥਾਣੇ ਵਿੱਚ ਜਾਂਦਾ ਹੈ ਹਾਲ ਹੀ ਵਿੱਚ ਜਿਹੜਾ ਇੰਸੀਡੈਂਸ ਹੋਇਆ ਸੀ ਉਹ ਸਾਡੇ ਨਾਲ ਹੀ ਹੋਇਆ ਸੀ ਸਾਡੇ ਘਰ ਦੇ ਪਿਛਲੇ ਗੇਟ ਦੇ ਮੂਹਰੇ ਕਿਸੇ ਨੇ ਕੰਧ ਕਰਵਾ ਤੀ ਸੀ ਅਤੇ ਕਿਹਾ ਕਿ ਇਹ ਪਲਾਟ ਸਾਡਾ ਹੈ ਸਾਡੀ ਉਹਨਾਂ ਨਾਲ ਕਾਫੀ ਬਹਿਸ ਹੋਈ ਸਾਡੇ ਕੋਲ ਡੋਕੂਮੈਂਟ ਵੀ ਸੀਗੇ ਪਰ ਉਹ ਨਾ ਮੰਨੇ ਫਿਰ ਜਦੋਂ ਉਹ ਨਹੀਂ ਮੰਨੇ ਅਤੇ ਉਸ ਤੋਂ ਬਾਅਦ ਅਸੀਂ ਪਿੰਡ ਦੇ ਮੋਢੀ ਨੰਬਰਦਾਰ ਸੀਗੇ ਨੰਬਰਦਾਰ ਸਾਹਿਬ ਹੋਰਾਂ ਨੇ ਵਿੱਚ ਪੈ ਕੇ ਗੱਲ ਸੁਲਝਾਈ ਗੱਲ ਸੁਲਝਾਉਣ ਤੋਂ ਬਾਅਦ ਸਾਡਾ ਉਹਨਾਂ ਨੇ ਕ ਕੰਧ ਢਾਹ ਤੀ ਅਤੇ ਰਸਤਾ ਖੁੱਲ੍ਹ ਗਿਆ ਅਤੇ ਸਾਡੇ ਪਿੰਡ ਦਾ ਜਿਹੜਾ ਝਗੜਾ ਸੀਗਾ ਸਾਡਾ ਜਿਹੜਾ ਮਸਲਾ ਸੀਗਾ ਉਹ ਹੱਲ ਹੋ ਗਿਆ ਇਸ ਤਰੀਕੇ ਨਾਲ ਹੀ ਸਾਡੇ ਘਰ ਪਿੰਡ ਦੇ ਜਿੰਨੇ ਵੀ ਛੋਟੇ ਮੋਟੇ ਮਸਲੇ ਹੁੰਦੇ ਨੇ ਉਹ ਇਸ ਤਰੀਕੇ ਨਾਲ ਹੀ ਹੱਲ ਹੋ ਜਾਂਦੇ ਨੇ ਪਿੰਡ ਇੱਕ ਪਰਿਵਾਰ ਦੀ ਤਰ੍ਹਾਂ ਹੁੰਦਾ ਹੈ ਜ਼ਿਆਦਾਤਰ ਲੋਕ ਉੱਥੇ ਪਰਿਵਾਰ ਦੀ ਤਰ੍ਹਾਂ ਰਹਿੰਦੇ ਨੇ ਖੁਸ਼ ਰਹਿੰਦੇ ਨੇ ਜ਼ਿਆਦਾਤਰ ਸਾਡੇ ਪਿੰਡ ਵਿੱਚ ਝਗੜੇ ਹੁੰਦੇ ਵੀ ਨਹੀਂ